ਜਦੋਂ ਵੀ ਮੈਨੂੰ ਕੁਛ ਨਵਾਂ ਬਣਾਉਣਾ ਪੈਂਦਾ ਹੈ ਤਾਂ ਮੈਂ ਯੂਟਿਊਬ ਦੀ ਸਹਾਇਤਾ ਲੈਂਦੀ ਹਾਂ ਜੀ ਯੂਟਿਊਬ ਦੀ ਸਹਾਇਤਾ ਕਰਕੇ ਖਾਣਾ ਬਣਾਉਣਾ ਆਸਾਨ ਹੋ ਜਾਂਦਾ ਹੈ ਕਿਉਂਕਿ ਉਹ ਹਰ ਹਰ ਇੱਕ ਸਟੈੱਪ ਬਹੁਤ ਹੀ ਚੰਗੀ ਤਰ੍ਹਾਂ ਵਿਆਖਿਆ ਕਰਦੇ ਹਨ ਹਾਲ ਹੀ ਵਿੱਚ ਮੈਂ ਸਾਂਭਰ ਡੋਸਾ ਜੋ ਕਿ ਸਾਊਥ ਇੰਡੀਅਨ ਡਿਸ਼ ਹੈ ਬਣਾਉਣ ਦੀ ਕੋਸ਼ਿਸ਼ ਕੀਤੀ ਕੀਤੀ ਬਟ ਪਰ ਮੈਂ ਉਸ ਵਿੱਚ ਅਸਫਲ ਰਹੀ ਫਿਰ ਮੈਂ ਯੂਟਿਊਬ ਉੱਤੇ ਸੰਜੀਵ ਕਪੂਰ ਦੁਆਰਾ ਦਿੱਤੀ ਹੋਈ ਰੈਸਪੀ ਰੈਸਪੀ ਦੇਖੀ ਅਤੇ ਉਸ ਦੇ ਅਨੁਸਾਰ ਸਾਂਭਰ ਡੋਸਾ ਬਣਾਉਣਾ ਸ਼ੁਰੂ ਕੀਤਾ ਹਰ ਹਰੇਕ ਸਟੈੱਪ ਫੋਲੋ ਕਰਨ ਤੋਂ ਬਾਅਦ ਮੇਰਾ ਡੋਸਾ ਬਹੁਤ ਹੀ ਵਧੀਆ ਬਣਿਆ ਜੋ ਕਿ ਇੱਕ ਬਹੁਤ ਸ਼ਾਨਦਾਰ ਤਜ਼ਰਬਾ ਰਿਹਾ ਮੈਨੂੰ ਉਹ ਬਹੁਤ ਪਸੰਦ ਆਇਆ ਮੇਰੇ ਘਰਦਿਆਂ ਨੇ ਸਾਂਭਰ ਡੋਸਾ ਬਹੁਤ ਹੀ ਖੁਸ਼ ਹੋ ਕੇ ਖਾਇਆ